ਹਾਂਜੀ ਸਿੰਘ ਕੈਟਰਿੰਗ ਸਰਵਿਸ ਸਤਿ ਸ਼੍ਰੀ ਅਕਾਲ ਜੀ ਅੱਛਾ ਜੀ ਅਤੇ ਆਪਾਂ ਇਸ ਵਿੱਚ ਨਾ ਬਰੇਕਫਾਸਟ ਵੀ ਇੰਨਕਲੂਡ ਕਰ ਸਕਦੇ ਹਾਂ ਜਿੱਦਾਂ ਤੁਹਾਡੀ ਪਾਰਟੀ ਹੁੰਦੀ ਹੈ ਨਾ ਅਗਲੇ ਦਿਨ ਪਹਿਲਾ ਦਿਨ ਤਾਂ ਤੁਸੀਂ ਲੰਚ ਡਿਨਰ ਕਰ ਲਿਆ ਅਗਲੇ ਦਿਨ ਦਾ ਅਸੀਂ ਬ੍ਰੇਕਫਾਸਟ ਵੀ ਕਰ ਸਕਦੇ ਹਾਂ ਅਤੇ ਇਹ ਵੀ ਤੁਸੀਂ ਸੋਚ ਲਉ ਜੇਕਰ ਕਿਉਂਕਿ ਬਾਰਾਤ ਆ ਕੇ ਠਹਿਰੇਗੀ ਤਾਂ ਉਹਦਾ ਵੀ ਅਰੇਂਜਮੈਂਟ ਅਸੀਂ ਕਰਕੇ ਦੇ ਸਕਦੇ ਹਾਂ ਤੁਹਾਨੂੰ ਇਹਦੇ ਅੰਦਰ ਜਿਹੜਾ ਸਾਡਾ ਸਿਸਟਮ ਅਸੀਂ ਰੱਖਿਆ ਪੈਕੇਜ ਦਾ ਪਰ ਪਲੇਟ ਦਾ ਸਿਸਟਮ ਰੱਖਿਆ ਇੱਕ ਤਾਂ ਗੱਲ ਸਾਨੂੰ ਇਹ ਦੱਸੋ ਤੁਸੀਂ ਰੋਟੀ ਕਰਨੀ ਕਿੱਦਾਂ ਦੀ ਹੈ ਵੈਜੀਟੇਰੀਅਨ ਹੈ ਕਿ ਆਪਾਂ ਨੋਨ ਵੈਜੀਟੇਰੀਅਨ ਵੀ ਨਾਲ ਰੱਖਣਾ ਅੱਛਾ ਜੀ ਅਤੇ ਇਹਦੇ ਅੰਦਰ ਨਾ ਸਾਡਾ ਜਿਹੜਾ ਪੈਕੇਜ ਬਣਦਾ ਹੈ ਉਸ ਵਿੱਚ ਨੰਬਰ ਔਫ ਡਿਸ਼ਿਸ ਦਾ ਹੈ ਕਿ ਆਪਾਂ ਕਿੰਨੇ ਆਈਟਮ ਰੱਖਣੇ ਹੈਗੇ ਹੈ ਅਤੇ ਚਾਹ ਦਾ ਵੀ ਇੰਤਜ਼ਾਮ ਕਰਨਾ ਨਹੀਂ ਕਰਨਾ ਚਾਹ ਦੇ ਨਾਲ ਕੌਫੀ ਚਾਹੀਦੀ ਹੈ ਸਵੀਟ ਡਿਸ਼ ਵਿੱਚ ਕਿੰਨੀਆਂ ਸਵੀਟ ਡਿਸ਼ਾਂ ਚਾਹੀਦੀਆਂ ਨੇ ਅਤੇ ਥੋੜ੍ਹਾ ਜਿਹਾ ਇਹ ਵਾਲਾ ਸਾਨੂੰ ਆਈਡੀਆ ਦਿਓਗੇ ਤਾਂ ਅਸੀਂ ਤੁਹਾਨੂੰ ਪੈਕੇਜ ਦੱਸ ਦਿੰਦੇ ਹਾਂ ਕਿਹੜਾ ਤੁਹਾਨੂੰ ਚੰਗਾ ਪਊਗਾ ਲੰਚ ਤੋਂ ਸ਼ੁਰੂ ਕਰੀਏ ਜਿਹੜਾ ਪਹਿਲਾ ਦਿਨ ਦਾ ਲੰਚ ਹੈ ਤੁਸੀਂ ਆਪਣਾ ਨੂੰ ਕੇਵਲ ਰੋਟੀ ਕਰਨੀ ਹੈ ਕਿ ਨਾਲ ਆਪਾਂ ਸਟਾਲ ਵੀ ਲਗਾਉਣੇ ਹੈ ਕਿ ਤੁਹਾਡੇ ਮਸਾਲਾ ਡੋਸਾ ਇਹ ਸਾਰੇ ਸਟਾਲ ਵੱਖਰੇ ਲੱਗਦੇ ਹੈ ਟਿੱਕੀ ਦਾ ਹੋ ਗਿਆ ਇਹ ਸਾਰੇ ਸਟਾਲ ਵੱਖਰੇ ਲੱਗਦੇ ਹੈਗੇ ਹੈ ਮੇਨ ਕੋਰਸ 'ਤੇ ਕੀ ਹੋ ਜਾਂਦਾ ਹੈ ਕਿ ਤੁਹਾਡੀ ਮਿਕਸ ਰੋਟੀਆਂ ਹੋ ਜਾਂਦੀਆਂ ਨੇ ਅਤੇ ਨਾਲ ਦਾਲ ਮੱਖਣੀ ਹੋ ਗਈ ਛੋਲੇ ਹੋ ਗਏ ਰਾਜਮਾਂਹ ਹੋ ਗਏ ਇਹਨਾਂ ਵਿੱਚ ਜਿਹੜਾ ਆਇਟਮ ਤੁਸੀਂ ਚੂਜ਼ ਕਰਨਾ ਹੈ ਇੱਕ ਆਇਟਮ ਚੂਜ਼ ਕਰ ਸਕਦੇ ਹੋ ਅਤੇ ਮਿਕਸ ਵੈਜ ਹੋ ਗਈ ਇੱਕ ਅਤੇ ਸਲਾਦ ਪਾਪੜ ਆਚਾਰ ਇਹ ਤਾਂ ਅਸੀਂ ਕੰਪਲੀਮੈਂਟਰੀ ਦਿੰਦੇ ਹਾਂ ਆਪਣੀ ਤਰਫ਼ੋਂ ਅਤੇ ਹਾਂਜੀ ਪਨੀਰ ਵੀ ਕਰ ਦਿਆਂਗੇ ਜੀ ਬਿਲਕੁਲ ਪਨੀਰ ਮਸ਼ਰੂਮ ਜਿਹੜਾ ਤੁਸੀਂ ਕਹੋਂਗੇ ਉਹ ਨਾਲ ਐਡ ਕਰ ਦਿਆਂਗੇ ਅਤੇ ਇਹ ਤੋਂ ਬਾਅਦ ਜੇਕਰ ਨਾਲ ਸਨੈਕਸ ਰੱਖਣੇ ਹੈ ਤਾਂ ਤੁਸੀਂ ਦੱਸੋ ਤੁਸੀਂ ਇੱਕ ਕੰਮ ਕਰਿਓ ਜੀ ਸਾਡੀ ਇੱਥੇ ਸ਼ੋਪ 'ਤੇ ਆ ਜਾਉ ਅਤੇ ਅਸੀਂ ਬਹਿ ਕੇ ਇਹਨੂੰ ਫਾਈਨਲ ਕਰ ਲੈਂਦੇ ਹਾਂ ਸਰ ਹਜ਼ਾਰ ਰੁਪਏ ਪਰ ਪਲੇਟ ਪੈਣਾ ਹੈ ਜੀ ਤੁਹਾਨੂੰ ਓਕੇ ਜੀ